ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਨਹੀਂ ਮੌਸਮ ਇੱਧਰ ਸਾਫ ਹੈ ਹਾਂਜੀ ਹਾਂਜੀ ਸਰ ਮੌਸਮ ਬਹੁਤ ਵਧੀਆ ਸਾਫ ਸੁਥਰਾ ਹੈ ਏਰੀਆ ਬਹੁਤ ਵਧੀਆ ਇੱਧਰ ਹਾਂ ਸਰਦੀਆਂ 'ਚ ਬਹੁਤ ਵਧੀਆ ਰਹਿੰਦਾ ਯਾਰ ਠੀਕ ਰਹਿੰਦਾ ਨਾ ਉਰੇ ਠੰਡ ਹੁੰਦੀ ਆ ਨੌਰਮਲ ਚਲਦਾ ਵਧੀਆ ਰਹਿਣ ਦਾ ਤਾਂ ਪੀਜੀ ਬਥੇਰੇ ਰਹਿਣ ਨੂੰ ਉਹ ਤੇਰੇ ਹਿਸਾਬ ਨਾਲ ਆ ਵੀ ਤੂੰ ਕਿਹੜੇ ਕਿਹੜੇ ਏਰੀਏ ਮ ਰਹਿਣਾ ਚਾਹੁੰਦਾ ਹਾਂ ਕੋਲਜ ਦੇ ਨੇੜੇ ਮਿਲ ਜਾਣਾ ਪੀਜੀ ਦਾ ਫਰਕ ਹੁੰਦਾ ਵੀ ਕਿੱਦਾਂ ਮਤਲਬ ਕਿ ਕਿੱਥੇ ਰਹਿਣਾ ਚਾਹੁੰਦਾ ਉਸ ਹਿਸਾਬ ਨਾਲ ਕਿਰਾਇਆ ਹੈ ਉਰੇ ਪੀਜੀ ਦਾ ਅਤੇ ਕੋਲਜ ਕੋਲਜ ਦੇ ਨੇੜੇ ਨੇੜੇ ਹੀ ਹੈ ਅੱਧੇ ਕਿਲੋਮੀਟਰ ਦੇ ਅੰਦਰ ਅੰਦਰ ਪੀਜੀ ਮਿਲ ਜਾਣਾ ਤੈਨੂੰ ਬਹੁਤ ਵਧੀਆ ਹਾਂ ਵਿਦ ਪੀਜੀ ਵੀ ਦੇ ਦਿੰਦੇ ਆ ਰੂਮ ਵੀ ਦੇ ਦਿੰਦੇ ਤੂੰ ਬਾਹਰੋਂ ਲੈਣਾ ਤਾਂ ਬਾਹਰੋਂ ਵੀ ਖਾ ਸਕਦਾ ਆਪਣਾ ਆਮ ਸਾਦਾ ਜਿਹਾ ਮੌਸਮ ਠੀਕ ਰਹਿੰਦਾ ਯਾਰ ਵਧੀਆ ਪ੍ਰਬੰਧ ਹੈ ਇੱਥੇ ਹਾਂ ਹਾਂ ਵਾਧੂ ਹੈ ਹਾਂ ਬਾਈਕ ਰੈਂਟ 'ਤੇ ਮਿਲ ਜਾਂਦੀ ਹੈ ਉਹ ਬਾਕੀ ਹੁੰਦਾ ਅਪਣੇ ਬੰਦੇ ਬੰਦੇ ਪਰ ਡਿਪੈਂਡ ਹੁੰਦਾ ਵੀ ਕਿੱਦਾਂ ਰੱਖਣੀ ਹੈ ਉਹ ਹਾਂ ਹਾਂ ਮੌਸਮ ਬਹੁਤ ਵਧੀਆ ਬਥੇਰੇ ਹੈ ਓਕੇ ਜੀ